ਹਾਂ ਜਿਸ ਤਰ੍ਹਾਂ ਕਿ ਅਸੀਂ ਸਾਫ਼ ਸਫਾਈ ਜੇ ਆਪਣੇ ਇਲਾਕੇ ਵਿੱਚ ਆਪਣੇ ਮਹੱਲੇ ਵਿੱਚ ਰੱਖੀਏ ਤਾਂ ਇਹ ਬਹੁਤ ਹੀ ਅੱਛਾ ਸੰਦੇਸ਼ ਸਮਾਜ ਨੂੰ ਜਾਂਦਾ ਹੈ ਸਭ ਤੋਂ ਪਹਿਲਾਂ ਤਾਂ ਸਫਾਈ ਸਾਨੂੰ ਆਪਣੇ ਘਰ ਤੋਂ ਹੀ ਸ਼ੁਰੂ ਕਰਨੀ ਚਾਹੀਦੀ ਹੈ ਘਰ ਨੂੰ ਸਾਫ਼ ਸੁਥਰਾ ਰੱਖੀਏ ਉਸ ਤੋਂ ਬਾਅਦ ਘਰ ਤੋਂ ਬਾਹਰ ਨਿਕਲ ਕੇ ਆਪਣੀ ਅਸੀਂ ਮੁਹੱਲੇ ਨੂੰ ਆਪਣੀ ਕੋਲਣੀ ਨੂੰ ਆਪਣੀ ਗਲੀ ਨੂੰ ਸਾਫ਼ ਸੁਥਰਾ ਰੱਖੀਏ ਕਿਤੇ ਵੀ ਕੋਈ ਚੀਜ਼ ਕਿਤੇ ਤੁਰੇ ਵੀ ਜਾ ਰਹੇ ਹੋ ਅਸੀਂ ਰਸਤੇ ਵਿੱਚ ਵਿੱਚ ਚੀਜ਼ ਕਿਉਂ ਉਹਦਾ ਅਸੀਂ ਕੋਈ ਖਾਂਦੇ ਪੀਦੇ ਛਿਲਕਾ ਜਾਂ ਕਾਗਜ਼ ਦਾ ਟੁਕੜਾ ਜਾਂ ਹੋਰ ਨਾ ਸਿਟੀਏ ਜੇ ਅਸੀਂ ਸਕੂਟਰ 'ਤੇ ਜਾ ਰਹੇ ਹਾਂ ਸਕੂਟਰ ਵਿਚ ਰੱਖ ਲਈਏ ਕਾਰ ਵਿਚ ਹੋਈਏ ਤਾਂ ਕਾਰ ਵਿਚ ਰੱਖ ਲਈਏ ਉਹ ਵੇਸਟ ਨੂੰ ਘਰ ਵਿੱਚ ਪਹੁੰਚ ਕੇ ਅਸੀਂ ਆਪਣੇ ਡਸਟਬੀਨ ਦੇ ਵਿੱਚ ਉਹ ਚੀਜ਼ ਨੂੰ ਪਾਈਏ ਇੱਕ ਛੋਟਾ ਜਿਹਾ ਸਾਡਾ ਉਪਰਾਲਾ ਇਹ ਬਾਕੀਆਂ ਨੂੰ ਸੰਦੇਸ਼ ਵੀ ਮਿਲੂਗਾ ਔਰ ਬਾਕੀ ਵੀ ਚੀਜ਼ ਇਸ ਕਦਮ ਨੂੰ ਇਹਦੇ ਉੱਤੇ ਚੱਲਣਗੇ ਤਾਂ ਅਸੀਂ ਆਪਣੇ ਆਪਣੇ ਪਹਿਲਾਂ ਪਹਿਲਾਂ ਤਾਂ ਸਮਾਜ ਆਪਣੇ ਘਰ ਨੂੰ ਉਸ ਤੋਂ ਬਾਅਦ ਅਸੀਂ ਆਪਣੀ ਕੋਲਣੀ ਨੂੰ ਉਸ ਤੋਂ ਬਾਅਦ ਸ਼ਹਿਰ ਨੂੰ ਉਸ ਤੋਂ ਬਾਅਦ ਪੰ ਪੂਰੇ ਸ਼ਹ ਡਿਸਟ੍ਰਿਕਟ ਨੂੰ ਉਸ ਤੋਂ ਬਾਅਦ ਸਟੇਟ ਨੂੰ ਔਰ ਉਸ ਤੋਂ ਬਾਅਦ ਸ਼ਹਿ ਪੂਰੇ ਪੂਰੇ ਦੇਸ਼ ਨੂੰ ਅਸੀਂ ਸਾਫ਼ ਰੱਖਣ ਵਿੱਚ ਬਹੁਤ ਹੀ ਵੱਡਾ ਉਪਰਾਲਾ ਕਰ ਸਕਦੇ ਹਾਂ ਵਾਂ ਇੱਕ ਨੇ ਇੱਕ ਕਿੱਦਾਂ ਕਰਦਾ ਕਰਦਾ ਬੰਦਾ ਉਹਨੂੰ ਕਈ ਲੋਕ ਦੇਖਣਗੇ ਤਾਂ ਸਾਰੇ ਉਸ ਚੀਜ਼ ਨੂੰ ਅਪਣਾਉਣਗੇ ਜਿਹੜਾ ਕਿ ਅਸੀਂ ਬਹੁਤ ਅੱਛੇ ਕਰ ਸਕਦੇ ਹਾਂ ਔਰ ਸਾਨੂੰ ਇਹਦੇ ਨਾਲ ਨਾਲ ਸਾਨੂੰ ਆਪਣੀ ਕੋਲਣੀ ਵੀ ਜਿੱਥੇ ਸਾਨੂੰ ਪੌਦੇ ਵੀ ਜ਼ਰੂਰ ਲਾਉਣੇ ਚਾਹੀਦੇ ਆ ਪੌਦਿਆਂ ਅੱਛੀ ਹਵਾ ਦਿੰਦੇ ਆ ਆਕਸੀਜਨ ਦਿੰਦੇ ਆ ਔਰ ਉਹਨਾਂ ਨਾਲ ਅੱਛਾ ਵਾਤਾਵਰਣ ਬਣਦਾ ਆ ਔਰ ਅਸੀਂ ਸਮਾਜ ਨੂੰ ਇਹ ਅੱਛੀ ਚੀਜ਼ਾਂ ਦੇ ਸਕਦੇ ਹਾਂ ਇਹ ਉਪਰਾਲਾ ਸਾਨੂੰ ਆਪਣੇ ਘਰ ਤੋਂ ਹੀ ਕਰਦੇ ਕਰਦੇ ਹਰ ਕਮੀ ਦੀ ਪਹਿਲ ਕਰਨੀ ਚਾਹੀਦੀ ਆ ਤਾਂ ਕਿ ਅਸੀਂ ਇਸ ਪਹਿਲ ਨੂੰ ਦੇਸ਼ ਤੀਕਰ ਲੈ ਜਾਈਏ ਔਰ ਦੇਸ਼ ਨੂੰ ਸਾਫ਼ ਸੁਥਰਾ ਬਣਾਈਏ ਇੱਕ ਸਾਡੇ ਇੱਕ ਬੰਦੇ ਦੀ ਪਹਿਲ ਸਾਰਿਆਂ ਨੂੰ ਅੱਛਾ ਸੰਦੇਸ਼ ਦੇ ਸਕਦੀ ਆ ਮੈਂ ਤਾਂ ਆਪਣੇ ਵੱਲੋਂ ਇਹ ਹੀ ਸਮਝਦਾਂ ਸਭ ਤੋਂ ਪਹਿਲਾਂ ਘਰ ਉਸ ਤੋਂ ਬਾਅਦ ਆਪਣੇ ਮੁਹੱਲੇ ਗਲੀ 'ਚ ਆਪਣੀ ਕੌਲਣੀ 'ਚ ਉਸ ਤੋਂ ਬਾਅਦ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਉਪਰਾਲਾ ਹਰ ਕਦਮ 'ਤੇ ਸਾਨੂੰ ਕਰਨਾ ਚਾਹੀਦਾ ਹੈ